ਹਾਂਜੀ ਮੈਂ ਕਿਸੇ ਨੂੰ ਪੇਂਟਿੰਗ ਜਾਂ ਹੱਥ ਨਾਲ ਬਣੇ ਕਾਰਡ ਦਾ ਹੀ ਤੋਹਫਾ ਦੇਣਾ ਪਸੰਦ ਕਰਦੀ ਹਾਂ ਕਿਉਂਕਿ ਇੱਕ ਤਾਂ ਮੇਰੇ ਐਂ ਹੈਗੀ ਹੈ ਥਿੰਕਿੰਗ ਕਿ ਇੱਕ ਤਾਂ ਉਹ ਬਜ਼ਾਰੋਂ ਤੁਸੀਂ ਲਿਆਉਂਦੇ ਹੋ ਜ਼ਰਾ ਬਮ ਉਹ ਕਾਫੀ ਹੁੰਦਾ ਮਹਿੰਗਾ ਫੇਰ ਉਹ ਮਹਿੰਗਾ ਹੋਣ ਦੇ ਬਾਵਜੂਦ ਵੀ ਥੋੜ੍ਹੀ ਦੇਰ ਬਾਅਦ ਉਹ ਡਸਟਬਿੰਨ 'ਚ ਸੁੱਟਿਆ ਜਾਣਾ ਵੈ ਅਤੇ ਇਹਦੇ ਨਾਲ ਕੋਈ ਤੁਹਾਡੀ ਭਾਵਨਾਵਾਂ ਕਿੰਨੀ ਕੁ ਰਹਿ ਗਈ ਬਸ ਤੁਹਾਨੂੰ ਇਹੀ ਹੈ ਤੁਹਾਡਾ ਤੁਸੀਂ ਆਪਣੀ ਅਮੀਰੀ ਦਾ ਪ੍ਰਦਰਸ਼ਨ ਕਰ ਲਿਆ ਪਰ ਜੇ ਅਸੀਂ ਅਮੀਰੀ ਦਾ ਪ੍ਰਦਰਸ਼ਨ ਨਹੀਂ ਕਰਨਾ ਅਤੇ ਆਪਣੇ ਜਜ਼ਬਾਤ ਪੂਰੇ ਪ੍ਰਦਰਸ਼ਨ ਕਰਨੇ ਆ ਫੀਲਿੰਗਸ ਉਹਦੇ 'ਚ ਹੁੰਦੀਆਂ ਅਤੇ ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣੇ ਹੱਥ ਨਾਲ ਹੀ ਬਣਾ ਕੇ ਦਿਉ ਸਸਤਾ ਦਾ ਸਸਤਾ ਤੁਹਾਡੀਆਂ ਫੀਲਿੰਗ ਜੁੜੀਆਂ ਹੋਈਆਂ ਉਹਦੇ ਨਾਲ ਅਤੇ ਸਸਤੇ 'ਚ ਹੀ ਜੇ ਕੰਮ ਹੋ ਜਾਵੇ ਵਧੀਆ ਅਤੇ ਉਹ ਕਿੰਨਾ ਇੱਕ ਤਾਂ ਹੋ ਜਾਵੇਗਾ ਕਿ ਤੁਸੀਂ ਥੋੜ੍ਹਾ ਕ੍ਰਾਫਟ ਆਈਟਮ 'ਤੇ ਜੇ ਤੁਸੀਂ ਲਾਉਗੇ ਉਹਦੇ 'ਚ ਅਤੇ ਉਹ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਕਿ ਉਹ ਲੋਕ ਹੈਂਗ ਵੀ ਕਰ ਲੈਂਦੇ ਹੈ ਹੈਂਗ ਕਰਨ ਵਾਲਾ ਹੀ ਕਾਰਡ ਤੁਸੀਂ ਕੋਸ਼ਿਸ਼ ਕਰੋ ਕਿ ਬਣਾ ਕੇ ਦਿਉ ਬਰਡੇ ਵਾਲਾ ਜਾਂ ਕੋਈ ਨਿਊ ਈਅਰ ਦਾ ਕੋਈ ਦਿਵਾਲੀ ਦਾ ਕਾਰਡ ਹੈ ਤਾਂ ਇਹੋ ਜਿਹੇ ਕਾਰਡ ਅੱਜ ਕੱਲ੍ਹ ਇੰਨਾ ਕੁ ਜ਼ਿਆਦਾ ਹੁਣ ਤੁਸੀਂ ਦੇਖਦੇ ਹੋਊਗੇ ਹੋਟਲਾਂ 'ਚ ਵੀ ਹੈ ਜਿਹੜੇ ਚੀਪ ਐਂਡ ਬੈਸਟ ਹੀ ਡੈਕੋਰੇਸ਼ਨ ਹੋ ਰਹੀ ਹੈ ਅਤੇ ਅਸੀਂ ਕੋਸ਼ਿਸ਼ ਕਰਾਂਗੇ ਜੇ ਇੰਨੀ ਮਹਿੰਗਾਈ ਹੋ ਰਹੀ ਹੈ ਅਸੀਂ ਕੁਛ ਚੀਜ਼ਾਂ ਤਾਂ ਅਸੀਂ ਤਿਆਗ ਹੀ ਸਕਦੇ ਹਾਂ ਨਾ ਕਿ ਜਿਹੜੀਆਂ ਬਹੁਤ ਮਹਿੰਗੀਆਂ ਹੈਗੀਆਂ ਕੁਛ ਚੀਜ਼ਾਂ ਤੋਂ ਤਾਂ ਅਸੀਂ ਬਚ ਨਹੀਂ ਸਕਦੇ ਪਰ ਕੁਛ ਚੀਜ਼ਾਂ ਤੋਂ ਅਸੀਂ ਬਚ ਸਕਦੇ ਹੈ ਉਹ ਐਂ ਬਚ ਸਕਦੇ ਹੈ ਕਿ ਇਹ ਪੇਂਟਿੰਗ ਦੇ ਨਾਲ ਅਸੀਂ ਇੱਕ ਤਾਂ ਆਪਣਾ ਸਾਡਾ ਡਿਵੈਲਪ ਹੋਏਗਾ ਵਿਚਾਰ ਇੱਕ ਸਸਤਾ ਦਾ ਸਸਤਾ ਇੱਕ ਉਹਦੇ 'ਚ ਸਾਰੇ ਜਜ਼ਬਾਤ ਵੀ ਹੋਣਗੇ ਅਤੇ ਇੱਕ ਉਹ ਚੀਪ ਐਂਡ ਬੈਸਟ ਅਤੇ ਸ ਲੋਕ ਸੰਭਾਲ ਕੇ ਵੀ ਰੱਖਦੇ ਹੈ ਹੈਂਗ ਵੀ ਕਰ ਸਕਦੇ ਹੈ ਅਤੇ ਉਹ ਕਾਫੀ ਦੇਰ ਤੁਹਾਡੇ ਕੋਲ ਰਹਿੰਦਾ ਵੀ ਹੈ ਉਹ ਡਸਟਬਿੰਨ 'ਚ ਨਹੀਂ ਜਾਂਦਾ ਬਸ